ਵੈਸੇ ਤਾਂ ਅੱਜ ਕੱਲ੍ਹ ਪਿੰਡਾਂ ਅਤੇ ਸ਼ਹਿਰਾਂ ਦੇ ਘਰਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਪਿੰਡ ਦੇ ਘਰ ਜਿੱਥੇ ਬਹੁਤ ਵੱਡੀ ਜਗ੍ਹਾ 'ਤੇ ਬਣੇ ਹੁੰਦੇ ਨੇ ਸ਼ਹਿਰਾਂ ਦੇ ਘਰ ਓਨੀ ਹੀ ਛੋਟੀ ਜਗ੍ਹਾ 'ਤੇ ਬਣੇ ਹੁੰਦੇ ਨੇ ਜੇ ਤੁਸੀਂ ਪਿੰਡਾਂ ਦੇ ਘਰਾਂ ਦੀ ਗੱਲ ਕਰੋਗੇ ਤਾਂ ਪਿੰਡਾਂ ਦੇ ਘਰ ਵਿੱਚ ਵਿਹੜਾ ਵੀ ਬਹੁਤ ਵੱਡਾ ਹੁੰਦਾ ਹੈ ਅਤੇ ਸ਼ਹਿਰਾਂ ਦੇ ਘਰ ਦੀ ਗੱਲ ਕਰੋਗੇ ਤਾਂ ਸ਼ਹਿਰਾਂ ਦੇ ਘਰ ਵਿੱਚ ਬਹੁਤ ਵਿਹੜਾ ਛੋਟਾ ਹੀ ਹੁੰਦਾ ਹੈ ਜ਼ਿਆਦਾਤਰ ਬਹੁਤ ਘੱਟ ਇਹੋ ਜਿਹੇ ਘਰ ਨੇ ਜਿੱਥੇ ਵਿਹੜਾ ਬਹੁਤ ਵੱਡਾ ਹੋਵੇ ਵੈਸੇ ਮੈਂ ਵੀ ਪਿੰਡ ਦਾ ਹੀ ਰਹਿਣ ਵਾਲਾ ਹਾਂ ਅਤੇ ਮੈਂ ਪਿੰਡ 'ਚ ਇੱਕ ਨਵਾਂ ਘਰ ਬਣਾਉਣ ਡਿਆ ਹਾਂ ਪਿੰਡ ਦੇ ਵਿੱਚ ਘਰ ਬਣਾਉਣ ਦਾ ਰੀਜਨ ਇਹ ਹੈ ਕਿ ਮੈਨੂੰ ਬਹੁਤ ਬਹੁਤ ਚੰਗਾ ਲੱਗਦਾ ਹੈ ਪਿੰਡ ਦੇ ਵਿੱਚ ਘਰ ਬਣਾਉਣਾ ਕਿਉਂਕਿ ਮੈਂ ਇੱਥੇ ਰਹਿਣ ਵਾਲਾ ਹਾਂ ਅਤੇ ਮੈਂ ਇੱਥੇ ਮੈਂ ਹੁਣ ਨਵਾਂ ਘਰ ਬਣਾ ਕੇ ਵੀ ਬਹੁਤ ਖੁਸ਼ ਹਾਂ ਪਿੰਡ ਦੇ ਵਿੱਚ ਘਰ ਜੇ ਮੈਂ ਬਣਾਉਣਾ ਹੈ ਤਾਂ ਮੈਂ ਕਾਫੀ ਵੱਡਾ ਘਰ ਬਣਾਉਣਾ ਚਾਹੂੰਗਾ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਕੁੱਲ ਦਸ ਮੈਂਬਰ ਨੇ ਪਹਿਲੇ ਮੈਂ ਮੇਰੇ ਮੰਮੀ ਪਾਪਾ ਮੇਰੀ ਛ ਵੱਡੀ ਭੈਣ ਮੇਰੇ ਦੋ ਛੋਟੇ ਭੈਣ ਭਰਾ ਅਤੇ ਮੇਰੇ ਚਾਚਾ ਚਾਚੀ ਅਤੇ ਦਾਦਾ ਦਾਦੀ

ਅਤੇ ਤੀਸਰਾ ਮੇਰੀ ਮੰਮੀ ਪਾਪਾ ਲਈ ਹੋਵੇ ਅਤੇ ਚੌਥਾ ਦਾਦਾ ਦਾਦੀ ਦੇ ਲਈ ਹੋਵੇ ਅਤੇ ਇੱਕ ਗੁਰੂ ਘਰ ਚਾਹੀਦਾ ਹੈ ਜਿੱਥੇ ਅਸੀਂ ਪੂਜਾ ਪਾਠ ਕਰ ਸਕੀਏ ਉਹਦੇ ਵਿੱਚ ਅਸੀਂ ਆਪਣੀ ਪੂਜਾ ਕਰ ਪੂਜਾ ਕਰਨਾ